ਪੰਜਾਬ ਵਿੱਚ ਬਹੁਤ ਸਾਰੇ ਸੱਭਿਆਚਾਰਕ ਪਰੰਪਰਾ ਹਨ ਜਿਸ ਤਰ੍ਹਾਂ ਵਿਆਹ ਦੇ ਸਮੇਂ ਵਿੱਚ ਸੁਹਾਗ ਗਾਏ ਜਾਂਦੇ ਹਨ ਘੋੜੀਆਂ ਗਾਈਆਂ ਜਾਂਦੀਆਂ ਹਨ ਢੋਲ ਵਜਾਏ ਜਾਂਦੇ ਹਨ ਅਤੇ ਰੀਤੀ ਰਿਵਾਜ਼ ਆ ਜਿਹੜੇ ਜਿਸ ਤਰ੍ਹਾਂ ਵਿਆਹ ਦੇ ਸਮੇਂ ਘੋੜੀਆਂ ਗਾਈਆਂ ਜਾਂਦੀਆਂ ਸੁਹਾਗ ਗਾਏ ਜਾਂਦੇ ਹਨ ਜਾਗੋ ਕੱਢੀ ਜਾਂਦੀ ਹੈ ਜਿਹੜਾ ਪਹਿਰਾਵਾ ਉਹ ਮਰਦ ਤਾਂ ਲਾਉਂਦੇ ਨੇ ਜਿਸ ਤਰ੍ਹਾਂ ਚਾਦਰਾ ਅਤੇ ਕੁੜਤਾ ਅਤੇ ਤੁਰਲੇ ਵਾਲੀ ਪੱਗੜੀ ਜਿਹੜੀਆਂ ਜਨਾਨੀਆਂ ਨੇ ਉਹ ਸਲਵਾਰ ਸੂਟ ਫੁਲਕਾਰੀ ਜਾਂ ਫੇਰ ਘੱਗਰਾ ਜੋ ਕਿ ਪੰਜਾਬ ਦੀਆਂ ਬਹੁਤ ਹੀ ਮਸ਼ਹੂਰ ਡਰੈਸਾਂ ਹਨ ਉਹ ਪਹਿਨਦੇ ਨੇ ਬਾਕੀ ਜੋ ਖਾਣਾ ਉਹ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਇਹ ਸਭ ਨਾਲੋਂ ਵਧੀਆ ਮਤਲਬ ਮੰਨਿਆ ਜਾਂਦਾ